ਹਾਂਜੀ ਸਤਿ ਸ਼੍ਰੀ ਅਕਾਲ ਜੀ ਸਿਹਤ ਸੰਬੰਧੀ ਉਦਯੋਗ ਹੈ ਅਤੇ ਜ਼ਿਆਦਾਤਰ ਦੇਸ਼ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਕਰਮਚਾਰੀਆਂ ਦਾ ਇੱਕ ਪ੍ਰਮੁੱਖ ਖੇਤਰ ਹੈ ਉਹਨਾਂ ਵਿੱਚ ਬਹੁਤ ਸਾਰੀਆਂ ਸ ਟੀਗਾਂ ਸੈਟਿੰਗਾਂ ਵਿੱਚ ਕੰਮ ਕਰਨ ਵਾਲੇ ਪੇਸ਼ੇਵਰ ਤਕਨੀਕ ਅਤੇ ਸਹਾਇਤਾ ਕਰਮਚਾਰੀਆਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਿਲ ਹੁੰਦੀ ਹੈ ਸਿਹਤ ਪੇਸ਼ਾਵਰ ਪ੍ਰਯੋਗਸ਼ਾਲਾ ਸਮਾਜਿਕ ਵਰਕਰਾਂ ਅਤੇ ਕਲੀਨਿਕ ਸੇਵਾਵਾਂ ਵਿੱਚ ਸ਼ਾਮਿਲ ਹੋਣ ਤੋਂ ਇਲਾਵਾ ਉਹਨਾਂ ਵਿੱਚ ਪ੍ਰਸ਼ਾਸਨਿਕ ਕਰਮਚਾਰੀਆਂ ਅਤੇ ਖੁਰਾਕ ਸਟਾਫ ਕਰਮਚਾਰੀਆਂ ਸ਼ਾਮਿਲ ਹਨ ਜੋ ਇਮਾਰਤ ਦੀ ਮੁਰੰਮਤ ਆਦਿ ਅਤੇ ਇਸ ਵਿੱਚ ਸ਼ਾਮਿਲ ਉਪਕਰਨ ਹਨ ਸਿੱਧੀ ਦੇਖ ਸੰਭਾਲ ਪ੍ਰਦਾਨ ਕਰਨ ਵਾਲੇ ਲੋਕਾਂ ਦੇ ਉਲਟ ਇਹਨਾਂ ਸਹਾਇਤਾ ਕਰਮਚਾਰੀਆਂ ਦਾ ਆਮ ਤੌਰ 'ਤੇ ਮਰੀਜ਼ਾਂ ਨਾਲ ਸਿਰਫ ਆਮ ਅਚਾਰ ਸੰਪਰਕ ਹਨ ਰਾਜ ਸਿਹਤ ਸੰਭਾਲ ਪੇਸ਼ਾਵਰ ਲਈ ਲਈ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ ਜਿਵੇਂ ਕਿ ਹੋਸਪਿਟਲ ਆਦਿ ਬਣਾਉਣੇ ਚਾਹੀਦੇ ਹਨ ਤਾਂ ਕਿ ਤਾਂ ਕਿ ਲੋਕਾਂ ਨੂੰ ਸੌਖਾ ਹੋ ਜਾਵੇ ਅਤੇ ਮਤਲਬ ਕਿ ਬੇਰੁਜ਼ਗਾਰਾਂ ਨੂੰ ਨੌਕਰੀਆਂ ਆਦੀਆਂ ਦੇਣੀਆਂ ਚਾਹੀਦੀਆਂ ਹਨ ਸਿਹਤ ਸੰ ਸਿਹਤ ਸੰਭਾਲ ਪੇਸ਼ਾਵਾਰ ਲਈ ਲਈ ਸਰਕਾਰੀ ਹਸਪਤਾਲ ਆਦਿ ਖੋਲ੍ਹਣੇ ਚਾਹੀਦੇ ਹਨ